ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਵਾਤਾਵਰਨ ਨੂੰ ਸੰਭਾਲਣ ਲਈ ਪਹਿਲਕਦਮੀਆਂ ਤਾਂ ਬਹੁਤ ਸਾਰੀਆਂ ਚੱਕੀਆਂ ਗਈਆਂ ਹਨ ਸਰਕਾਰ ਦੇ ਵੱਲੋਂ ਇਹਨਾਂ ਵਿੱਚੋਂ ਮੈਂ ਕੁਝ ਕੁ ਪਹਿਲਕਦਮੀਆਂ ਬਾਰੇ ਗੱਲ ਕਰਨੀ ਚਾਹੂੰਗੀ ਜਿਵੇਂ ਕੀ ਜਦੋਂ ਪੰਜਾਬ ਦੇ ਵਿੱਚ ਹੜ੍ਹਾਂ ਵਰਗੇ ਮਾਹੌਲ ਬਣ ਗਏ ਸਨ ਤਾਂ ਉਸ ਟਾਈਮ 'ਤੇ ਦਰਿਆ ਦੇ ਨਾਲ ਲੱਗਦੇ ਜਿੰਨੇ ਵੀ ਇਲਾਕੇ ਸਨ ਉੱਥੇ ਭੂ ਖੋਰ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਵੱਲੋਂ ਇੱਕ ਪਹਿਲਕਦਮੀ ਲਈ ਗਈ ਸੀ ਜਿਸ ਦੇ ਵਿੱਚ ਡੰਗੇ ਲਗਾਉਣੇ ਸ਼ੁਰੂ ਕੀਤੇ ਗਏ ਸੀਗੇ ਇਹਦੇ ਵਿੱਚ ਕੀ ਸੀਗਾ ਕਿ ਦਰਿਆਵਾਂ ਦੇ ਕੰਡੇ ਜੋ ਵੀ ਅ ਉਪਜਾਊ ਜਮੀਨ ਸੀਗੀ ਉਹਦੀ ਉਹਨੂੰ ਭੂ ਖੋਰ ਹੋਣ ਤੋਂ ਰੋਕਣ ਦੇ ਲਈ ਵੱਡੇ ਵੱਡੇ ਪੱਥਰਾਂ ਨੂੰ ਜਾਲ ਦੇ ਵਿੱਚ ਬੰਨ੍ਹ ਕੇ ਦਰਿਆਵਾਂ ਦੇ ਕੰਢੇ 'ਤੇ ਲਗਾਇਆ ਗਿਆ ਤਾਂ ਕਿ ਅਸੀਂ ਜਿਹੜਾ ਭੂ ਖੋਰ ਆ ਉਹਨੂੰ ਰੋਕੀਏ ਰੋਕਿਆ ਜਾ ਸਕੇ ਇਹਦੇ ਤੋਂ ਬਿਨਾਂ ਮੈਂ ਇੱਕ ਐਸਕੇਟੀ ਪਲਾਂਟੇਸ਼ਨ ਟੀਮ ਦਾ ਹਿੱਸਾ ਹਾਂ ਜਿਹਦਾ ਕਿ ਮੇਨ ਉਦੇਸ਼ ਹੀ ਜਿਹੜਾ ਆ ਵਾਤਾਵਰਨ ਨੂੰ ਸੰਭਾਲਣਾ ਹੈ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਅਸੀਂ ਬ ਅ ਨਵਾਂਸ਼ਹਿਰ ਜ਼ਿਲ੍ਹੇ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਜਾ ਕੇ ਅਸੀਂ ਰੁੱਖ ਲਗਾਉਂਦੇ ਹਾਂ ਅਤੇ ਉਹਨਾਂ ਰੁੱਖਾਂ ਨੂੰ ਲਗਾ ਕੇ ਅਸੀਂ ਵਾਤਾਵਰਨ ਨੂੰ ਸਾਫ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਅਸੀਂ ਆਪਣੇ ਵਾਤਾਵਰਨ ਨੂੰ ਬਚਾ ਸਕੀਏ ਇਹਨਾਂ ਰੁੱਖਾਂ ਨੂੰ ਲਗਾਉਣ ਦੇ ਸਮੇਂ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਆ ਮੁਸੀਬਤਾਂ ਵੀ ਦੇਖਣੀਆਂ ਪੈਂਦੀਆਂ ਹੈ ਬਹੁਤ ਸਾਰੇ ਚੈਲੇਂਜਿਜ਼ ਚੈਲੇਂਜਿਜ਼ ਸਾਡੇ ਸਾਹਮਣੇ ਆਉਂਦੇ ਆ ਜਿਵੇਂ ਕਿ ਕਈ ਵਾਰੀ ਅ ਲੋਕ ਜਿਹੜੇ ਆ ਉਹ ਸਾਨੂੰ ਅ ਰੁੱਖ ਲਗਾਉਣ ਦੇ ਲਈ ਕੋਈ ਵੀ ਜਮੀਨ ਵਗੈਰਾ ਨਹੀਂ ਦਿੰਦੇ ਆ ਜਾਂ ਫਿਰ ਕਈ ਵਾਰ ਹੁੰਦਾ ਕੀ ਜਿੱਥੇ ਅਸੀਂ ਰੁੱਖ ਲਗਾ ਕੇ ਆਏ ਹਾਂ ਲੋਕ ਉਹਨਾਂ ਨੂੰ ਪੁੱਟ ਕੇ ਸੁੱਟ ਦਿੰਦੇ ਆ ਅਤੇ ਉਹਦੇ ਕਰਕੇ ਜਿਹੜਾ ਆ ਸਾਨੂੰ ਇਹ ਪ੍ਰੋਬਲਮ ਆਉਂਦੀ ਹੈ ਕਿ ਅਸੀਂ ਕਿੱਥੇ ਅਸੀਂ ਆਪਣੇ ਰੁੱਖਾਂ ਨੂੰ ਲਗਾਈਏ ਬਟ ਫਿਰ ਵੀ ਜੇ ਇਹਦੇ ਪੋਜੀਟਿਵ ਪੁਆਇੰਟਸ ਦੀ ਗੱਲ ਕਰਾਂ ਤਾਂ ਅਸੀਂ ਬਹੁਤ ਸਾਰੇ ਰੁੱਖ ਅੱਜ ਨਵਾਂਸ਼ਹਿਰ ਦੇ ਵਿੱਚ ਲਗਾ ਚੁੱਕੇ ਹਾਂ ਜਿਹੜੇ ਕਿ ਜਿਹੜੇ ਕਿ ਸਾਨੂੰ ਆਪਣੇ ਵੱਲੋਂ ਅਸੀਂ ਇੱਕ ਹਿੱਸਾ ਪਾ ਰਹੇ ਹਾਂ ਕਿ ਅਸੀਂ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਵਾਤਾਵਰਨ ਨੂੰ ਜਿਹੜਾ ਹੈ ਆ ਸਾਫ ਸੁਥਰਾ ਰੱਖ ਸਕੀਏ ਅਤੇ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾ ਸਕੀਏ